ਹਾਂਜੀ ਮੈਂ ਆਪਣੇ ਸਕੂਲ ਦੇ ਸਮੇਂ ਦੇ ਦੌਰਾਨ ਮੈਂ ਆਪਣੇ ਦੋਸਤਾਂ ਦੇ ਨਾਲ ਇੱਕ ਸਾਇੰਸ ਪ੍ਰਦਰਸ਼ਨੀ ਦੇ ਵਿੱਚ ਆਪਣੀ ਕਲਾਕਾਰੀ ਦਿਖਾਈ ਸੀ ਜਿੱਥੇ ਕਿ ਅਸੀਂ ਇੱਕ ਮੋਡਲ ਤਿਆਰ ਕੀਤਾ ਸੀ ਜੋ ਕਿ ਜਵਾਲਾਮੁਖੀ ਦਾ ਸੀ ਅਤੇ ਅਸੀਂ ਇਸਨੂੰ ਦਿਖਾਉ ਇਸਨੂੰ ਦਿਖਾਉਣਾ ਸੀ ਕਿ ਇਹ ਕਿੱਦਾਂ ਫਟਦਾ ਹੈ ਅਤੇ ਇਸ ਵਿੱਚੋਂ ਕਿਸ ਕਿਸ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਸਨ ਇਹ ਅਨੁਭਵ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਜ਼ਿਆਦਾ ਵਧੀਆ ਅਨੁਭਵ ਸੀ ਕਿਉਂਕਿ ਅਸੀਂ ਸਟੇਟ ਲੈਵਲ ਉੱਤੋਂ ਫਰਸਟ ਪ੍ਰਾਈਜ਼ ਜਿੱਤਿਆ ਸੀ ਜੋ ਕਿ ਇੱਕ ਕੈਸ਼ ਵਜੋਂ ਸੀ ਅਤੇ ਸਾਨੂੰ ਉਸ ਸਮੇਂ ਦਸ ਹਜ਼ਾਰ ਰੁਪਏ ਦਾ ਇਨਾਮ ਮਿਲਿਆ ਸੀ ਅਤੇ ਸਾਡੀ ਫੋਟੋ ਨਿਊਜ਼ਪੇਪਰ ਵਿੱਚ ਵੀ ਆਈ ਸੀ ਅਤੇ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇਨਾਮ ਦਿੱਤਾ ਸੀ ਅਤੇ ਇਸ ਤੋਂ ਇਲਾਵਾ ਮੇਰੇ ਇਹ ਮੇਰੇ ਲਈ ਬਹੁਤ ਜ਼ਿਆਦਾ ਅਨੁਭਵ ਇਸ ਲਈ ਵੀ ਸੀ ਕਿਉਂਕਿ ਮੇਰੇ ਮਾਤਾ ਪਿਤਾ ਬਹੁਤ ਖੁਸ਼ ਸਨ ਅਤੇ ਪਿੰਡ ਦੇ ਵਿੱਚ ਸਾਰੇ ਲੋਕ ਮੈਨੂੰ ਇਸ ਲਈ ਮੁਬਾਰਕਾਂ ਦੇ ਰਹੇ ਸਨ